ਰੋਪੜ ਵਿੱਚ ਬਹੁਤ ਸਾਰੇ ਕਿੱਤੇ ਹਨ ਜਿਹਨਾਂ ਵਿੱਚੋਂ ਕਿ ਭਾਨੇ ਦੀ ਹੱਟੀ ਕੱਪੜੇ ਦੀ ਕੁੜਤੇ ਪਜਾਮੇ ਦੀ ਹੋਰ ਕਾਫ਼ੀ ਸ਼ੋਪਾਂ ਹਨ ਔਰ ਰਾਜ ਕੌਟਨ ਕਲੱਬ ਦੇ ਨਾਮ 'ਤੇ ਵੀ ਸ਼ੋਪ ਹੈ ਜਿਸ ਦੇ ਵਿੱਚ ਬੱਚਿਆਂ ਦੀ ਹਰੇਕ ਆਈਟਮ ਮਿਲ ਜਾਂਦੀ ਹੈ ਜਿਵੇਂ ਕਿ ਪੈਂਟਾਂ ਸ਼ਰਟਾਂ ਬੂਟ ਟਾਈ ਆਦਿ ਸਭ ਕੁਛ ਉਸ ਦੁਕਾਨ 'ਤੇ ਅਵੇਲੇਬਲ ਹੁੰਦਾ ਹੈ ਇਸ ਤੋਂ ਇਲਾਵਾ ਇਸ ਇਸ ਤੋਂ ਇਲਾਵਾ ਸਵਰਾਜ ਜਿੱਥੇ ਕਿ ਗੱਡੀਆਂ ਤਿਆਰ ਕੀਤੀ ਜਾਂਦੀਆਂ ਹਨ ਉੱਥੋਂ ਗੱਡੀਆਂ ਦੀ ਹਰੇਕ ਤਰ੍ਹਾਂ ਦਾ ਸਮਾਨ ਉਪਲੱਬਧ ਹੈ ਇਸ ਤੋਂ ਇਲਾਵਾ ਰਣਬੈਕਸੀ ਜਿੱਥੇ ਕਿ ਦਵਾਈਆਂ ਮੈਡੀਸਨ ਵਗੈਰਾ ਤਿਆਰ ਕੀਤੀਆਂ ਜਾਂਦੀਆਂ ਹਨ